ਮੈਂ ਹਾਂਜੀ ਮੈਂ ਘਰ ਵਾਸਤੇ ਆਪਣੇ ਰਸੋਈ ਲਈ ਕੁਝ ਪਲਾਸਟਿਕ ਦੇ ਡੱਬੇ ਮੰਗਵਾਏ ਜੋ ਕਿ ਬਹੁਤ ਗੰਦੇ ਸਨ ਡੱਬਿਆਂ ਵਿੱਚ ਸਮੈਲ ਵੀ ਆ ਰਹੀ ਸੀ ਅਤੇ ਦੇਖਣ ਵਿੱਚ ਵੀ ਵਧੀਆ ਨਹੀਂ ਲੱਗ ਰਹੇ ਸੀ ਅਤੇ ਮੈਂ ਇਹ ਸੋਚ ਕੇ ਮੰਗਵਾਏ ਸੀ ਕਿ ਇਹ ਟੱਪਰ ਵੀਅਰ ਦੇ ਹਨ ਪਰ ਉਹਨਾਂ ਨੇ ਡੁਪਲੀਕੇਟ ਮੈਨੂੰ ਡੱਬੇ ਭੇਜ ਦਿੱਤੇ ਵਾਪਸੀ ਦੀ ਵੀ ਕੋਈ ਆਪਸ਼ਨ ਨਹੀਂ ਸੀ ਅਤੇ ਮੇਰੇ ਪੈਸੇ ਵੀ ਖ਼ਰਾਬ ਹੋ ਗਏ ਇਸ ਕਰਕੇ ਜਦੋਂ ਵੀ ਕੋਈ ਡੱਬੇ ਮੰਗਾਏ ਤਾਂ ਕੰਪਨੀ ਤੋਂ ਹੀ ਮੰਗਵਾਓ ਆਮ ਜਿਹੜੇ ਫਲੋਟ ਕਰਦੇ ਨੇ ਉਹਨਾਂ ਕੰਪਨੀਆਂ ਤੋਂ ਨਾ ਮੰਗਵਾਉਣ ਤਾਂ ਕਿ ਆਪਣੇ ਪੈਸੇ ਨਾ ਖ਼ਰਾਬ ਹੋਣ